ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜਕੱਲ੍ਹ ਟੈਕਨੋਲੋਜੀ ਬਹੁਤ ਵੱਧ ਰਹੀ ਹੈ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਪਲੈਟਫਾਰਮ ਵੀ ਬਹੁਤ ਬਹੁਤ ਵੱਧ ਰਿਹਾ ਹੈ ਅਤੇ ਅੱਜ ਕੱਲ੍ਹ ਜ਼ਿਆਦਾਤਰ ਲੋਕ ਬਾਜ਼ਾਰੋਂ ਸ਼ੋਪਿੰਗ ਕਰਨ ਦੀ ਬਜਾਏ ਆਨਲਾਈਨ ਸ਼ੋਪਿੰਗ ਬਹੁਤ ਕਰ ਰਹੇ ਨੇ

ਨਾ ਆਪਣੇ ਭੈਣ ਲਈ ਅਤੇ ਆਪਣੇ ਲਈ ਇਹ ਕੱਪੜੇ ਦੇਖ ਰਹੇ ਸੀ ਅਤੇ ਮੈਨੂੰ ਉਹਦੇ ਵਿੱਚ ਕਾਫੀ ਕੁਛ ਪਸੰਦ ਆਇਆ ਪਰ ਮੇਰੇ ਕੋਲ ਇੰਨੇ ਪੈਸੇ ਨਹੀਂ ਸੀਗੇ ਕਿ ਮੈਂ ਇਕੱਠਾ ਹੀ ਸਭ ਕੁਝ ਲੈ ਸਕਾਂ ਤਾਂ ਮੈਂ ਉਸ ਚੀਜ਼ਾਂ ਨੂੰ ਸੇਵ ਕਰਕੇ ਰੱਖ ਰਹੀ ਸੀ ਫੋਨ ਵਿੱਚ ਇੱਕ ਫੀਚਰ ਹੁੰਦਾ ਐਡ ਟੂ ਕਾਰਟ ਮੈਂ ਨਾ ਉਹਦੇ ਵਿੱਚ ਆਪਣੇ ਚੀਜ਼ਾਂ ਸੇਵ ਕਰਕੇ ਰੱਖ ਰਹੀ ਸੀ ਕਿ ਜਦੋਂ ਮੇਰੇ ਕੋਲ ਪੈਸੇ ਆਉਣਗੇ ਮੈਂ ਇੱਦਾਂ ਦਾ ਉਹ ਬਾਅਦ 'ਚ ਲੈ ਲਉਂਗੀ ਅਤੇ ਕਈ ਵਾਰ ਇੱਦਾਂ ਵੀ ਹੁੰਦਾ ਕਿ ਮਤਲਬ ਔਨਲਾਈਨ ਐਪਸ 'ਤੇ ਸੇਲ ਵਗੈਰਾ ਵੀ ਬਹੁਤ ਹੁੰਦੀਆਂ ਨੇ ਜੋ ਚੀਜ਼ ਆਪਾਂ ਪਸੰਦ ਕੀਤੀ ਆ ਉਹ ਕੁਝ ਦਿਨਾਂ ਬਾਅਦ ਸਾਨੂੰ ਡਿਸਕਾਊਂਟ ਵੀ ਮਿਲ ਜਾਂਦਾ ਉਹਨਾ ਚੀਜ਼ਾਂ ਬਾਰੇ ਅਤੇ ਇਕੱਲੇ ਪੈਸਿਆਂ ਕਰਕੇ ਨਹੀਂ ਮੈਂ ਟਾਈਮ ਕਰਕੇ ਵੀ ਕਹਿ ਰਹੀਂ ਕਿ ਆਪਣਾ ਟਾਈਮ ਵੀ ਬਚ ਰਿਹਾ ਕਿ ਜਿਵੇਂ ਆਪਾਂ ਸਾਰਾ ਜੇ ਆ ਆਪਾਂ ਉਹ ਚੀਜ਼ ਬਾਅਦ 'ਚ ਲੈਣੀ ਵੀ ਹੈ ਅਤੇ ਆਪਾਂ ਸਾਰਾ ਵੇਖਣ ਦੀ ਬਜਾਏ ਜਿਹੜੀ ਆਪਾਂ ਐਡ ਟੂ ਕਾਰਟ ਵਿੱਚ ਆਪਣੀ ਚੀਜ਼ ਸੇਵ ਕਰਕੇ ਰੱਖੀ ਆ ਫਟਾਫਟ ਉਹਦੇ ਚੋਂ ਕੱਢ ਕੇ ਲੈ ਸਕਦੇ ਹਾਂ ਅਤੇ ਹੋਰ ਕਈ ਵਾਰ ਇੱਦਾਂ ਵੀ ਹੁੰਦਾ ਕਿ ਆਪਣਾ ਉਹ ਚੀਜ਼ ਬਾਰੇ ਮਨ ਵੀ ਬਦਲ ਜਾਂਦਾ ਹੈ ਤਾਂ ਕਰਕੇ ਵੀ ਮੈਂ ਸੇਵ ਕਰ ਲੈਨੀ ਹਾਂ ਕਿ ਹੁ ਕੀ ਪਤਾ ਹੁਣ ਟਾਈਮ 'ਤੇ ਉਹ ਪਸੰਦ ਆ ਅੱਗੇ ਨਾ ਆਵੇ ਤਾਂ ਕਰਕੇ ਮੈਂ ਉਸ ਚੀਜ਼ ਨੂੰ ਸੇਵ ਕਰ ਲੈਨੀ ਹਾਂ ਅਤੇ ਹੋਰ ਮੈਂ ਬਸ ਇਹੀ ਕਹਿਣਾ ਚਾਹੁੰਦੀ ਹਾਂ ਅੰਤ ਵਿੱਚ ਕਿ ਮੈਨੂੰ ਇਹ ਚੀਜ਼ ਵਧੀਆ ਲੱਗੀ ਕਿ ਇਸ ਨਾਲ ਲੋਕਾਂ ਦਾ ਟਾਈਮ ਵੀ ਘੱਟ ਬਚਦਾ ਹੈ ਅਤੇ ਮਤਲਬ ਟਾਈਮ ਦੀ ਵੀ ਬੱਚਤ ਹੁੰਦੀ ਆ ਅਤੇ ਕਈ ਵਾਰ ਉਹ ਇੱਦਾਂ ਵੀ ਹੁੰਦਾ ਕਿ ਜਿਵੇਂ ਸੇਲ ਵਗੈਰਾ ਹੁੰਦੀ ਆ ਅਤੇ ਬੰਦੇ ਨੂੰ ਡਿਸਕਾਊਂਟ ਵੀ ਮਿਲ ਜਾਂਦਾ ਹੈ ਇਹ ਚੀਜ਼ ਬਹੁਤ ਵਧੀਆ ਲੱਗੀ ਧੰਨਵਾਦ